ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਪਸ਼ੂਆਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਪੁੱਛਿਆ ਕਿ ਗਊਆਂ ਭੇਡਾਂ ਬੱਕਰੀਆਂ ਮੁਰਗੀਆਂ ਬਾਰੇ ਅਤੇ ਲੋਕ ਘਰਾਂ 'ਚ ਪਾਲਣਾ ਕਰਦੇ ਇਹਨਾਂ ਦੀ ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਵੀ ਘਰ ਦੇ ਵਿੱਚ ਗਾਂ ਔਰ ਮੱਝਾਂ ਰੱਖੀਆਂ ਹੋਈਆਂ ਸੀਗੀਆਂ ਜਦੋਂ ਮੈਂ ਬਚਪਨ ਤੋਂ ਦੇਖਿਆ ਮੇਰੇ ਡੈਡੀ ਮੰਮਾ ਨੇ ਅਤੇ ਗਊਆਂ ਰੱਖੀਆਂ ਸੀਗੀਆਂ ਇੱਕ ਬੱਕਰੀ ਵੀ ਰੱਖੀ ਹੋਈ ਸੀਗੀ ਘਰ ਦੀਆਂ ਗਊਆਂ ਮਝਾਂ ਰੱਖਣ ਫ਼ਾਇਦਾ ਆ ਕਿ ਘਰ ਦਾ ਦੁੱਧ ਸਹੀ ਪਿਓਰ ਹੁੰਦਾ ਵਾ ਸ਼ਕਤੀ ਵਾਲਾ ਹੁੰਦਾ ਆ ਜਿਸ ਕਾਰਨ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅਸੀਂ ਬਾਜ਼ਾਰ 'ਚੋਂ ਕੋਈ ਖਰੀਦਦੇ ਹਾਂ ਚੀਜ਼ ਤਾਂ ਉਹਨਾਂ ਦੇ ਵਿੱਚ ਮਿਲਾਵਟ ਹੁੰਦੀ ਆ ਬਹੁਤ ਸੋ ਇਸ ਲਈ ਅਸੀਂ ਵੈਸੇ ਵੀ ਖੇਤਾਂ 'ਚ ਰਹਿੰਦੇ ਹਾਂ ਅਤੇ ਉੱਥੇ ਦੱਸ ਪੰਦਰਾ ਮਰਲੇ ਜਗ੍ਹਾ ਸਿਰਫ਼ ਇਸ ਕੰਮ ਨੂੰ ਰੱਖੀ ਆ ਲਾਇਕ ਜਿੱਦਾਂ ਮੱਝਾਂ ਵੀ ਰੱਖੀਆਂ ਨੇ ਗਊਆਂ ਵੀ ਰੱਖੀਆਂ ਨੇ ਇੱਕ ਬੱਕਰੀ ਵੀ ਰੱਖੀ ਹੈ ਜਿੱਦਾਂ ਕਿ ਅੱਜ ਕੱਲ੍ਹ ਬੱਕਰੀ ਦੇ ਦੁੱਧ ਦੀ ਬਹੁਤ ਕੀਮਤ ਹੈ ਲਾਈਕ ਲੋਕਾਂ ਨੂੰ ਟਾਈਫਾਈਡ ਹੋ ਜਾਂਦਾ ਹੈ ਜੇ ਕਿਸੇ ਦੇ ਸੈੱਲ ਘੱਟ ਜਾਂਦੇ ਨੇ ਸੋ ਬੱਕਰੀ ਦਾ ਦੁੱਧ ਬਹੁਤ ਲਾਭਦਾਇਕ ਹੁੰਦਾ ਉਹਦੇ ਵਾਸਤੇ ਟਾਈਫਾਇਡ ਵਾਲਿਆਂ ਵਾਸਤੇ ਜਾਂ ਜਿਨ੍ਹਾਂ ਦੇ ਸੈਲ ਘੱਟ ਜਾਂਦੇ ਆ ਉਹਨਾਂ ਵਾਸਤੇ ਸੋ ਪਸ਼ੂ ਪਾਲਣ ਵਾਲਾ ਕੰਮ ਤਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਕਰਦੇ ਸੀ ਮੇਰੇ ਮੰਮੀ ਪਾਪਾ ਕਰਦੇ ਸੀ ਜਦੋਂ ਬਾਅਦ 'ਚ ਮੈਂ ਸਹੁਰੇ ਘਰ ਗਈ ਉੱਥੇ ਵੀ ਹੁੰਦਾ ਸੀਗਾ ਉੱਥੇ ਵੀ ਕਰਦੇ ਸੀਗੇ ਅਤੇ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ ਦੇਸੀ ਮੁਰਗੀਆਂ ਮੁਰਗੀ ਖਾਨਾ ਬਣਾਇਆ ਹੋਇਆ ਦੇਸੀ ਮੁਰਗੀਆਂ ਜਿੱਦਾਂ ਦੇਸੀ ਆਂਡੇ ਦਿੰਦੇ ਨੇ ਦਿੰਦੀਆਂ ਨੇ ਉਹ ਵੀ ਵਧੀਆ ਹੁੰਦੀਆਂ ਨੇ ਲਾਈਕ ਪ੍ਰੋਟੀਨ ਵਾਸਤੇ ਦੇਸੀ ਆਂਡੇ ਵਧੀਆ ਹੁੰਦੇ ਨੇ ਕਈ ਲੋਕਾਂ ਨੂੰ ਡਾਕਟਰ ਦੱਸਦੇ ਨੇ ਫਿਰ ਉਹ ਲੋਕ ਸਾਡੇ ਤੋਂ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਗਊਆਂ ਦਾ ਦੁੱਧ ਵੀ ਬਹੁਤ ਲਾਭਦਾਇਕ ਹੁੰਦਾ ਵਾ ਜਿੱਦਾਂ ਹਾਰਟ ਦੇ ਪੇਸ਼ੈਂਟ ਹੁੰਦੇ ਨੇ ਡਾਕਟਰ ਉਹਨਾਂ ਨੂੰ ਦੱਸਦੇ ਕਿ ਗਾਂ ਦਾ ਦੁੱਧ ਪੀਓ ਉਹ ਵੀ ਲੋਕ ਲੈ ਕੇ ਜਾਂਦੇ ਨੇ ਪਿਓਰ ਦੇਈਦਾ ਦੁੱਧ ਕੋਈ ਮਿਲਾਵਟ ਨਹੀਂ ਕਰੀਦੀ ਕਿਉਂਕਿ ਇਹ ਚੀਜ਼ਾਂ ਜਦੋਂ ਅਸੀਂ ਬਾਜ਼ਾਰੋਂ ਲੈਂਦੇ ਹਾਂ ਦੁੱਧ ਦਹੀਂ ਪਨੀਰ ਅਤੇ ਉਹ ਫਿਰ ਬਹੁਤ ਮਿਲਾਵਟ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਫ਼ਾਇਦਾ ਤਾਂ ਕਰਨਾ ਨਹੀਂ ਹੁੰਦਾ ਉਲਟਾ ਬਿਮਾਰੀਆਂ ਲਗਾਉਣੀਆਂ ਹੁੰਦੀਆਂ ਆ ਸੋ ਘਰ ਦੀ ਚੀਜ਼ ਭਾਵੇਂ ਥੋੜ੍ਹੀ ਹੋਵੇ ਪਰ ਉਹ ਪਿਓਰ ਹੁੰਦੀ ਆ ਲਾਭਦਾਇਕ ਹੁੰਦੀ ਆ ਕੋਈ ਸਰੀਰ ਨੂੰ ਨੁਕਸਾਨ ਨਹੀਂ ਕਰਦੀ ਇਸ ਤਰ੍ਹਾਂ ਗਾਂ ਵੀ ਰੱਖੀਆਂ ਹੋਈਆਂ ਨੇ ਮੱਝਾਂ ਵੀ ਰੱਖੀਆਂ ਹੋਈਆਂ ਨੇ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ ਜਿਨ੍ਹਾਂ ਦਾ ਘਰ ਦੇ ਪਸ਼ੂਆਂ ਦਾ ਬਹੁਤ ਫ਼ਾਇਦਾ ਹੁੰਦਾ ਆ ਜਾਨਵਰਾਂ ਦਾ ਅਤੇ ਉਹਨਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕਰੀਦੀ ਆ ਫੀਡ ਵਗੈਰਾ ਸਾਰਾ ਉਹਨਾਂ ਦੀ ਖੁਰਾਕ ਵੀ ਉਹਨਾਂ ਨੂੰ ਦੇਈ ਦੀ ਆ ਪ੍ਰੋਪਰ ਅਤੇ ਵਧੀਆ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰੀਦੀ ਆ ਅਤੇ ਘਰ ਦਾ ਦੁੱਧ ਦਹੀਂ ਪਨੀਰ ਸਾਰਾ ਵਰਤੀ ਦਾ ਵਾ ਅਤੇ ਜ਼ਰੂਰਤ ਅਨੁਸਾਰ ਜੇ ਕਿਸੇ ਨਾਲ ਲੋੜ ਹੁੰਦੀ ਆ ਤਾਂ ਉਹ ਲੈ ਵੀ ਜਾਂਦੇ ਨੇ ਦੇ ਵੀ ਦੇਈਦਾ ਆ ਲੋਕਾਂ ਨੂੰ ਸੋ ਮੇਰੀ ਤਾਂ ਇਹ ਹੀ ਸਲਾਹ ਆ ਕਿ ਜਿਹੜੇ ਤਾਂ ਲੋਕ ਪਿੰਡਾਂ 'ਚ ਰਹਿੰਦੇ ਨੇ ਜ਼ਰੂਰ ਘਰ ਦਾ ਹੀ ਦੁੱਧ ਵਰਤਣ ਬਾਜ਼ਾਰ ਲਿਆਉਣ ਨਾਲੋਂ ਅਤੇ ਘਰ ਦਾ ਦੁੱਧ ਵਧੀਆ ਹੁੰਦਾ ਆ ਲਾਭਦਾਇਕ ਹੁੰਦਾ ਆ